ਹੈਲੋ ਹਾਂ ਸਰ ਤੁਸੀਂ ਬਰਨਾਲਾ ਕਲੱਬ ਤੋਂ ਬੋਲ ਰਹੇ ਹੋ ਹਾਂ ਸਰ ਮੈਂ ਨਾ ਇੱਥੋਂ ਤੋਂ ਗੱਲ ਕਰ ਰਿਹਾ ਹੈਗਾ ਮੇਰੇ ਨਾ ਦੋ ਬੱਚੇ ਆ ਮੈਂ ਨਾ ਉਹਦੇ ਲਈ ਗੇਮਜ ਦੇ ਰਿਗਾਰਡਿੰਗ ਗੱਲ ਕਰਨੀ ਸੀ ਤੁਹਾਡੇ ਨਾਲ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਗੇਮਜ ਹੈਗੀ ਇੱਥੇ ਅੱਛਾ ਜੀ ਅੱਛਾ ਜੀ ਅੱਛਾ ਜੀ ਬੇਟਾ ਮੇਰਾ ਹੈਗਾ ਤੇਰਾਂ ਕੁ ਸਾਲ ਦਾ ਹੈ ਜੀ ਉਹਦੇ ਲਈ ਤਾਂ ਮੈਂ ਸਵਿਮਿੰਗ ਦੀ ਬਾਰੇ ਸੋਚ ਰਿਹਾ ਸੀਗਾ ਹਾਂ ਅਤੇ ਬੇਟੀ ਹੈਗੀ ਦਸ ਕੁ ਸਾਲ ਦੀ ਮੈਨੂੰ ਐਂ ਸੀ ਕਰਾਟੇ ਵਗੈਰਾ ਜੇ ਕਰਵਾਉਂਦੇ ਹੋ ਤਾਂ ਉਹ ਜ਼ਿਆਦਾ ਬੈਟਰ ਹੈਗਾ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਸਰ ਫਿਰ ਟਾਈਮਿੰਗ ਕੀ ਆ ਤੁਹਾਡਾ ਵੈਸੇ ਅੱਛਾ ਜੀ ਹਾਂਜੀ ਹਾਂਜੀ ਕਿਉਂ ਉਹ ਸਕੂਲ ਤੋਂ ਆਫਟਰ ਟਿਊਸ਼ਨ ਵੀ ਜਾਂਦੇ ਆ ਮੈਂ ਦੇਖਦਾ ਸੀ ਵੀ ਕੋਈ ਟਾਈਮ ਸੈੱਟ ਹੋ ਜਾਵੇ ਆਫਟਰ ਟਿਊਸ਼ਨ ਕੋਈ

ਹਾਂ ਹਾਂ ਠੀਕ ਹੈ ਜੀ ਠੀਕ ਜੀ ਮੈਂ ਨਾ ਡੈਮੋ ਕਲਾਸ ਕਰਵਾਊਂਗਾ ਜੀ ਇਹਨਾਂ ਦੀ ਦੋ ਦਿਨ ਜੇ ਸਾਨੂੰ ਸੈੱਟ ਲੱਗਿਆ ਬੱਚਿਆਂ ਨੂੰ ਠੀਕ ਲੱਗਿਆ ਤਾਂ ਅਸੀਂ ਐਡਮਿਸ਼ਨ ਕਰਵਾ ਦਾਂਗੇ ਜੀ ਤੁਹਾਡੇ ਕੋਲ ਅੱਛਾ ਜੀ ਹਾਂਜੀ ਹਾਂਜੀ ਅਤੇ ਫਿਰ ਆਪਾਂ ਐਡਮਿਸ਼ਨ ਕਰਵਾਈ ਦੇਵਾਂ ਜੀ ਮੈਂ ਲਿਆਉਂ ਸੈਚਰਡੇ ਲਿਆਊਂਗਾ ਜੀ ਬੱਚਿਆਂ ਨੂੰ ਹਾਂਜੀ ਹਾਂਜੀ ਠੀਕ ਹੈ ਸਰ ਓਕੇ ਜੀ ਥੈਂਕ ਯੂ ਸਰ